ਅਕਸਰ ਅਸੀਂ ਸਕੂਲ ਵਿੱਚ ਬਹੁਤ ਹੀ ਕਹਾਣੀਆਂ ਪੜ੍ਹਦੇ ਹਾਂ ਜਿਹਨਾਂ ਵਿੱਚ ਰਾਜਾ ਮਹਾਰਾਜਾ ਦੀ ਕਹਾਣੀ ਵੀ ਸਭ ਤੋਂ ਅਲੱਗ ਹੁੰਦੀ ਹੈ ਉਸੀ ਤਰ੍ਹਾਂ ਮੈਂ ਵੀ ਸਕੂਲ ਵਿੱਚ ਬਹੁਤ ਹੀ ਸਾਰੀਆਂ ਕਹਾਣੀਆਂ ਪੜ੍ਹੀਆਂ ਸੀ ਜਿਹਨਾਂ ਵਿੱਚੋਂ ਰਾਜਿਆਂ ਦੀਆਂ ਕਹਾਣੀਆਂ ਵੀ ਹਨ ਮੈਂ ਅੱਜ ਤੁਹਾਨੂੰ ਬਾਬਰ ਦੀ ਕਹਾਣੀ ਬਾਰੇ ਕੁਛ ਦੱਸਣਾ ਚਾਹਾਂਗੀ ਬਾਬਰ ਨੇ ਮੁਗਲ ਰਾਜ ਦੀ ਨੀਂਹ ਰੱਖੀ ਸੀ ਉਸਦੇ ਹਮਲਿਆਂ ਸਮੇਂ ਦੇ ਪੰਜਾਬ ਦੀ ਸਥਿਤੀ ਜੋ ਵੀ ਸੀ ਉਸ ਬਾਰੇ ਦੱਸਾਂਗੀ ਬਾਬਰ ਮੁਗਲ ਰਾਜ ਦੀ ਨੀਂਹ ਰੱਖੀ ਸੀ ਉਸ ਨੇ ਬਾਬਰ ਨੇ ਆਪਣੇ ਜੀਵਨ ਦੇ ਆਰੰਭ ਤੋਂ ਹੀ ਹਿੰਦੁਸਤਾਨ ਨੂੰ ਜਿੱਤਣ ਦਾ ਇਰਾਦਾ ਰੱਖਿਆ ਸੀ ਉਸ ਹੀ ਹਿੰਦੁਸਤਾਨ ਹਿੰਦੁਸਤਾਨ ਉੱਪਰ ਕਈ ਹਮਲੇ ਕੀਤੇ ਅਤੇ ਜਿੱਤਾਂ ਪ੍ਰਾਪਤ ਕੀਤੀਆਂ ਸੀ ਬਾਬਰ ਇੱਕ ਨਿਪੁੰਨ ਸੈਨਾਪਤੀ ਸੀ ਅਤੇ ਨਿਰਾਸ਼ ਨਹੀਂ ਹੁੰਦਾ ਸੀ ਉਸਨੇ ਆਪਣੇ ਰਾਜਕਾਲ ਵਿੱਚ ਬਹੁਤ ਸਾਰੇ ਮਹਿਲ ਬਣਾਏ ਸੀ ਉਹ ਇੱਕ ਬਹੁਤ ਚੰਗਾ ਲੇਖਕ ਵੀ ਸੀ ਉਸ ਨੂੰ ਵਿਦਵਾਨਾਂ ਅਤੇ ਲੇਖਕਾਂ ਲੇਖਕਾਂ ਦੀ ਸੰਗਤ ਪਸੰਦ ਸੀ ਬਾਬਰ ਤੋਂ ਬਾਅਦ ਉਸਦੇ ਪੁੱਤਰ ਨੇ ਦਿੱਲੀ ਦੀ ਸੱਤਾ ਸੰਭਾਲੀ ਸੀ ਇਹ ਸਭ ਥੋੜ੍ਹਾ ਬਹੁਤ ਬਾਬਰ ਬਾਰੇ ਹੈ ਜੋ ਵੀ ਮੈਨੂੰ ਯਾਦ ਹੈ ਅਤੇ ਹੋਰ ਵੀ ਬਹੁਤ ਚੀਜ਼ਾਂ ਹਨ ਜੋ ਬਾਬਰ ਨੇ ਕੀਤੀਆਂ ਸੀ ਹੁਣ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੈਨੂੰ ਸਭ ਤੋਂ ਆਕਰਸ਼ਿਤ ਚੀਜ਼ਾਂ ਕਿਹੜੀਆਂ ਲੱਗਦੀਆਂ ਹਨ ਸਾਡੇ ਇਤਿਹਾਸ ਬਾਰੇ ਸਾਡੇ ਇਤਿਹਾਸ ਬਾਰੇ ਮੈਨੂੰ ਆਕਰਸ਼ਿਤ ਜੋ ਲੱਗਦਾ ਹੈ ਕਿ ਜਿਵੇਂ ਭਾਰਤ ਵਿੱਚ ਆਜ਼ਾਦੀ ਤੋਂ ਪਹਿਲਾਂ ਜਿਹੜੇ ਰਾਜਾ ਮਹਾਰਾਜਾ ਸਨ ਉਹਨਾਂ ਦਾ ਅਕਸ ਕੁਛ ਅਜਿਹਾ ਹੈ ਕਿ ਉਹਨਾਂ ਨੂੰ ਯਾਦ ਕਰਦੇ ਹੀ ਦਿਮਾਗ ਵਿੱਚ ਹਾਥੀ ਘੋੜੇ ਨੱਚਦੇ ਹਨ ਅਤੇ ਰਾਜ ਮਹਿਲ ਦੀ ਕਲਪਨਾ ਤੈਰਨ ਲੱਗਦੀ ਹੈ ਇਸ ਕਰਕੇ ਮੈਨੂੰ ਆਪਣੇ ਰਾਜਿਆਂ ਦਾ ਇਤਿਹਾਸ ਬਹੁਤ ਹੀ ਪਸੰਦ ਹੈ ਧੰਨਵਾਦ